ਮੈਂ ਹਰ ਤਰ੍ਹਾਂ ਦੇ ਪੌਦੇ ਲਗਾਉਣਾ ਪਸੰਦ ਕਰਦੀ ਹਾਂ ਫੁੱਲ ਫਲ ਸਬਜ਼ੀਆਂ ਅਤੇ ਮੈਡੀਸਨਲ ਪਲਾਂਟ ਪਰ ਮੈਨੂੰ ਸਭ ਤੋਂ ਵੱਧ ਚੰਗਾ ਮੈਡੀਸਨਲ ਪਲਾਂਟ ਉਗਾਉਣਾ ਪਸੰਦ ਹੈ ਕਿਉਂਕਿ ਮੈਂ ਜ਼ਿਆਦਾ ਆਪਣੇ ਘਰ ਦੀ ਉਸ ਮੈਡੀਸਨਲ ਪਲਾਂਟਾਂ ਦੇ ਥਰੂ ਕੋਈ ਵੀ ਕਿਸਮ ਦੀ ਛੋਟੀ ਮੋਟੀ ਬਿਮਾਰੀ ਦਾ ਇਲਾਜ ਲਈ ਉਹ ਪ੍ਰਯੋਗ ਕਰਨਾ ਚੰਗਾ ਸਮਝਦੀ ਹਾਂ ਫੁੱਲ ਸਬਜ਼ੀਆਂ ਵੀ ਮੈਂ ਲਗਾਈਆਂ ਹੋਈਆਂ ਹਨ ਫੁੱਲ ਵੀ ਮੈਂ ਉਹਨਾਂ ਨੂੰ ਜਦੋਂ ਉਹ ਪੂਰੇ ਉੱਗ ਜਾਂਦੇ ਹਨ ਅਤੇ ਮੈਂ ਉਹਨਾਂ ਦੀ ਵਰਤੋਂ ਆਰਗੈਨਿਕ ਖਾਦ ਬਣਾਉਣ ਲਈ ਕਰਦੀ ਹਾਂ ਜੋ ਕਿ ਬਾਅਦ ਵਿੱਚ ਮੈਨੂੰ ਓਹ ਹੋਰ ਕਈ ਘਰ ਦੇ ਕੰਮਾਂ ਲਈ ਪ੍ਰਯੋਗ ਹੁੰਦੇ ਹਨ ਕੱਪੜੇ ਫੁੱਲਾਂ ਸਬਜ਼ੀਆਂ ਫਲਾਂ ਸਬਜ਼ੀਆਂ ਤੋਂ ਨਿੰਬੂ ਜਿੱਦਾਂ ਨਿੰਬੂ ਦੇ ਬੂਟਿਆਂ ਤੋਂ ਮੈਂ ਘਰ ਜ਼ਰੂਰ ਪ੍ਰਯੋਗ ਕਰਕੇ ਮੈਂ ਖਾਦ ਵੀ ਘਰ ਦੀ ਆਰਗੈਨਿਕ ਖਾਦ ਵੀ ਤਿਆਰ ਕਰਦੀ ਹਾਂ